ਸੱਤ ਫਰਵਰੀ ਉੱਨੀ ਸੌ ਨੜਿਨਵੇਂ ਸੱਤ ਮਈ ਦੋ ਹਜ਼ਾਰ ਇੱਕ ਸੱਤ ਸਪਤੰਬਰ ਦੋ ਹਜ਼ਾਰ ਇੱਕ ਉਨੱਤੀ ਨਵੰਬਰ ਦੋ ਹਜ਼ਾਰ ਦੋ ਸੱਤ ਜੁਲਾਈ ਦੋ ਹਜ਼ਾਰ ਤਿੰਨ